ਹੈਲੋ ਹਾਂਜੀ ਹਾਂਜੀ ਹਾਂਜੀ ਹਾਂਜੀ ਕੋਲਜ ਮੈਮ ਬਹੁਤ ਵਧੀਆ ਹੈਗਾ ਤੁਹਾਨੂੰ ਮੈਂ ਦੱਸਦਾ ਬ ਬਹੁਤ ਵਧੀਆ ਬਹੁਤ ਵਧੀਆ ਟੀਚਰ ਆ ਹਾਂਜੀ ਮੈਮ ਸਟੂਡੈਂਟ ਬਹੁਤ ਵਧੀਆ ਹੈਗੇ ਆ ਟੀਚਰਸ ਬਹੁਤ ਵਧੀਆ ਹੈਗੇ ਆ ਖੁੱਲ੍ਹਾ ਗਰਾਊਂਡ ਹੈਗਾ ਬਹੁਤ ਵਧੀਆ ਕੁਆਲੀਫਿਕੇਸ਼ਨ ਹੈਗੇ ਆ ਸ਼ਾਂਤ ਮਾਹੌਲ ਹੈ ਹਾਂਜੀ ਮੈਮ ਬਹੁਤ ਕੁਝ ਕੁਆਲੀਫਰਡ ਹੈ ਇਸ ਹਿਸਾਬ ਨਾਲ ਸਮਝਾਉਂਦੇ ਹੈ ਜਿਵੇਂ ਸਭ ਕੁਝ ਹੈ ਇਜਲੀ ਸਮਝ ਆ ਜਾਂਦਾ ਕੋਈ ਡਿਫੀਕਲਟ ਨਹੀਂ ਅਗਰ ਜੇ ਕੋਈ ਸਮਝ ਨਹੀਂ ਆ ਰਿਹਾ ਤਾਂ ਬਹੁਤ ਪਿਆਰ ਨਾਲ ਟਰੀਟ ਕਰਕੇ ਸਮਝਾਉਂਦੇ ਹੈ ਹਾਂਜੀ ਹਾਂਜੀ ਐਸੇ ਐਡਵਰਟ ਗੰਜ ਗੈਸਟ ਹਾਊਸ ਹੈਗਾ ਲੜਕੀਆਂ ਵਾਸਤੇ ਉੱਥੇ ਤੁਸੀਂ ਰਹਿ ਸਕਦੇ ਹੋ ਹਾਂਜੀ ਹਾਂਜੀ ਮੈਂਮ ਹਾਂ ਨਹੀਂ ਮੈਂਮ ਮੈਂ ਤਾਂ ਅ ਨਾਲ ਹੀ ਬੋਏਸ ਹੋਸਟਲ ਹੈ ਮੈਂ ਤਾਂ ਉੱਥੇ ਰਹਿਣਾ ਵੈਸੇ ਮੈਂ ਮਾਸੀ ਕੋਲ ਰਹਿੰਦਾ ਅਤੇ ਮੈਂ ਮਾਸੀ ਘਰ ਵੀ ਰਹਿੰਦਾ ਬਹੁਤ ਵਾਰੀ ਤਾਂ ਖਾ ਖਾਣੇ ਦਾ ਪੁੱਛਦੇ ਤਾਂ ਸਕੂਲ 'ਚ ਵੀ ਕੰਟੀਨ ਹੈ ਅਤੇ ਜੋ ਜਿੱਥੇ ਤੁਸੀਂ ਪੀ ਜੀ 'ਚ ਰਹੋਗੇ ਉੱਥੇ ਵੀ ਤੁਹਾਨੂੰ ਮਿਲ ਜਾਊਗਾ ਖਾਣਾ ਹਾ ਹਾਂਜੀ ਮੈਮ ਕੋਲਜ ਦਾ ਸਾਫ਼ ਸੁਥਰਾ ਹੁੰਦਾ ਬਾਕੀ ਪੀ ਜੀ ਦਾ ਮੈਂ ਪੁੱਛਿਆ ਨਹੀਂ ਕੋਈ ਆਪਣੀ ਜਾਣ ਪਛਾਣ ਹੈ ਨਹੀਂ ਉੱਥੇ ਮੌਸਮ ਮੈਮ ਬਹੁਤ ਵਧੀਆ ਪਰ ਕਦੇ ਕਦੇ ਹੋ ਜਾਂਦੀ ਗਰਮੀ ਥੋੜ੍ਹੀ ਵਾਵਾ ਪਰ ਮੌਸਮ ਬਹੁਤ ਵਧੀਆ ਠੰਡਾ ਮੌਸਮ ਹੈ

ਨਹੀਂ ਨਹੀਂ ਮੈਡਮ ਕੋਈ ਦਿੱਕਤ ਨਹੀਂ ਆਉਂਦੀ ਬਿਲਕੁਲ ਠੰਡਾ ਮੌਸਮ ਹੈ ਬੱਸਾਂ ਦੀ ਆਵਾਜਾਈ ਵੀ ਲੱਗੀ ਰਹਿੰਦੀ ਹੈ ਤੁਹਾਨੂੰ ਕੋਈ ਔਖਾ ਵੀ ਨਹੀਂ ਹੋਊਗਾ ਐਂ ਤਾਂ ਉਹ ਅਪ ਡਾਊਨ ਕਰਨ ਵਾਸਤੇ

ਹਾਂਜੀ ਹਾਂਜੀ ਹਾਂ ਹਾਂਜੀ ਹਾਂਜੀ ਠੀਕ ਹੈ ਜੀ